ਅਸੀਂ ਪੌਦੇ ਉਗਾਉਣ ਲਈ ਉਪਜਾਊ ਮਿੱਟੀ ਦੀ ਵਰਤੋਂ ਕਰਦੇ ਹਾਂ ਅਤੇ ਇਸ ਵਿੱਚੋਂ ਕਈ ਪ੍ਰਕਾਰ ਦੀ ਖਾਦ ਮਿਕਸ ਕਰਕੇ ਪਾਈ ਜਾਂਦੀ ਹੈ ਜ਼ਿਆਦਾਤਰ ਪੌਦਿਆਂ ਵਿੱਚ ਦੇਸੀ ਖਾਦ ਪਾਈ ਜਾਂਦੀ ਹੈ ਦੇਸੀ ਖਾਦ ਨੂੰ ਬਣਨ ਵਿਚ ਬਹੁਤ ਸਮਾਂ ਲੱਗਦਾ ਹੈ ਲਗਭਗ ਦੇਸੀ ਖਾਦ ਨੂੰ ਤਿਆਰ ਹੋਣ ਵਿੱਚ ਪੰਜ ਛੇ ਸਾਲ ਲੱਗ ਜਾਂਦੇ ਹਨ ਅਤੇ ਦੇਸੀ ਖਾਦ ਦੀ ਮਾਤਰਾ ਸਹੀ ਤਰੀਕੇ ਨਾਲ ਪੌਦੇ ਦੀਆਂ ਜੜ੍ਹਾ ਵਿੱਚ ਪਾਉਣੀ ਚਾਹੀਦੀ ਹੈ ਜ਼ਿਆਦਾ ਦੇਸੀ ਖਾਦ ਪੌਦੇ ਨੂੰ ਖਰਾਬ ਕਰ ਸਕਦੀ ਹੈ ਔਰਗੈਨਿਕ ਖਾਦ ਵਰਤਣੀ ਚਾਹੀਦੀ ਹੈ ਰਸਾਇਣਿਕ ਖਾਦ ਨਾਲੋਂ ਮਿੱਟੀ ਵਿੱਚ ਸਾਰੇ ਪੋਸ਼ਕ ਤੱਕ ਮੌਜੂਦ ਹੋਣੇ ਚਾਹੀਦੇ ਹਨ ਅਤੇ ਸਾਰੇ ਖਣਿਜ ਪਦਾਰਥ ਮੌਜੂਦ ਹੋਣੇ ਚਾਹੀਦੇ ਹਨ ਜਿਵੇਂ ਕਿ ਫਾਸ ਫਾਸਫੇਟ ਪੋਟਾਸ਼ੀਅਮ ਮੈਗਨੀਸ਼ੀਅਮ ਮਿੱਟੀ ਵਿੱਚ ਗੰਡੋਏ ਦੀ ਮਦਦ ਲੈਣੀ ਚਾਹੀਦੀ ਹੈ ਕਿਉਂਕਿ ਉਹ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਮਦਦ ਕਰਦਾ ਹੈ ਜਿੰਨਾਂ ਹੋ ਸਕੇ ਘਰ ਦੀ ਬਣਾਈ ਖਾਦ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਪੌਦਿਆਂ ਵਿੱਚੋਂ ਯੂਰੀਏ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪੌਦਿਆਂ ਨੂੰ ਖਰਾਬ ਅਤੇ ਖਰਾਬ ਕਰ ਸਕਦਾ ਹੈ ਅਤੇ ਮਿੱਟੀ ਨੂੰ ਵੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾ ਸਕਦਾ ਹੈ